ਹੈਲੋ ਸਤਿ ਸ਼੍ਰੀ ਅਕਾਲ ਭਾਜੀ ਭਾਜੀ ਤੁਹਾਡੀ ਦੁਕਾਨ 'ਤੇ ਨਾ ਪਰਸੋਂ ਇੱਕ ਕੰਪਿਊਟਰ ਔਰਡਰ ਕਰਿਆ ਸੀ ਜੋ ਜਿਹੜੀ ਡਿਲੀਵਰੀ ਤੁਸੀਂ ਮੈਨੂੰ ਕਿਹਾ ਸੀ ਕਿ ਮੈਂ ਚੌਵੀ ਘੰਟੇ ਵਿੱਚ ਵਿੱਚ ਮੈਂ ਤੁਹਾਨੂੰ ਕਰ ਦੂੰਗਾ ਅਤੇ ਪਰ ਮੈਨੂੰ ਡਿਲਵਰੀ ਇੱਕ ਤਾਂ ਲੇਟ ਮਿਲੀ ਹੈ ਇਸ ਲਈ ਜਦ ਮੈਂ ਹੁਣ ਓਪਨ ਕਰਿਆ ਆਪਣੇ ਕੰਪਿਊਟਰ ਬਾਕਸ ਤਾਂ ਇੱਕ ਇਹਦੀ ਸਕਰੀਨ ਨਹੀਂ ਚੱਲ ਰਹੀ ਪ੍ਰੋਪਰ ਇਹਦੇ ਵਿੱਚ ਝਰੀਟਾਂ ਪਈਆਂ ਹੋਈਆਂ ਨੇ ਅਤੇ ਜਿਹੜਾ ਇਹਦਾ ਚਾਰਜਿੰਗ ਪੁਆਇੰਟ ਆ ਉਹ ਸ਼ ਪਲੱਗ ਵੀ ਥੋੜ੍ਹਾ ਕਰੈਕ ਆਇਆ ਹੋਇਆ ਇਹਦੇ ਪਲੱਗ ਵਿੱਚ ਵੀ ਕਰੈਕ ਥੋੜ੍ਹੇ ਥੋੜ੍ਹੇ ਕਰੈਕ ਦਾਣੇ ਦਾਣੇ ਦਾਣੇ ਕਰੈਕ ਲੱਗੇ ਹੋਏ ਹਨ ਅਤੇ ਉਹਦੇ ਬਾਅਦ ਇੱਕ ਇਹਦੀ ਬੈਟਰੀ ਨਹੀਂ ਚੰਗੀ ਤਰ੍ਹਾਂ ਚੱਲ ਰਹੀ ਹੈਗੀ ਆ ਮੈਨੂੰ ਤਾਂ ਐਂ ਲੱਗ ਰਿਹਾ ਕਿ ਜਿੱਦਾਂ ਕਿ ਇਹ ਥੋੜ੍ਹੇ ਪੁਰਾਣਾ ਕੰਪਿਊਟਰ ਹੁੰਦਾ ਹੈ ਅਤੇ ਜਿ ਜਿਹਦੇ ਨਾਲ ਹੈ ਕਿ ਭਾਜੀ ਮੈਨੂੰ ਤਾਂ ਚਲਾਉਣ ਵਿੱਚ ਬਹੁਤ ਦਿੱਕਤ ਹੋ ਰਹੀ ਹੈ ਇਹਦੀ ਜੋ ਕੀਬੋਰਡ ਹੈ ਉਹ ਵੀ ਨਹੀਂ ਪ੍ਰੋਪਰ ਚੱਲ ਰਿਹਾ ਇਹਦੀ ਕੀਬੋਰਡ ਵੀ ਵਿੱਚ ਵਿੱਚ ਮਿਸ ਮਾਰ ਰਿਹਾ ਹੈ ਥੋੜ੍ਹਾ ਕੰਪਿਊਟਰ ਤੁਹਾਡਾ ਹੈਂਗ ਕਰ ਰਿਹਾ ਹੈ ਇਸ ਲਈ ਭਾਜੀ ਮੈਂ ਹੁਣ ਇਸ ਨੂੰ ਐਂ ਕਰਦਾਂ ਕਿ ਵਾਪਿਸ ਕਰਨ ਖਾਤਰ ਮੈਂ ਤੁਹਾਡੇ ਕੋਲ ਕੱਲ੍ਹ ਆਵਾਂਗਾ ਜਿਸ ਨਾਲ ਕਿ ਮੈਨੂੰ ਤੁਸੀਂ ਪੁਰਾਣਾ ਪੁਰਾਣੇ ਨਹੀਂ ਮੈਨੂੰ ਬਿਲਕੁਲ ਨਵਾਂ ਕੰਪਿਊਟਰ ਚਾਹੀਦਾ ਹੈ ਇਹ ਤੁਹਾਡੀ ਗਲਤੀ ਹੋਵੇ ਜਾਂ ਕਿਸੇ ਹੋਰ ਦੀ ਗਲਤੀ ਹੋਵੇ ਇਸ ਨਾਲ ਮੈਨੂੰ ਕੋਈ ਉਹ ਨਹੀਂ ਹੈਗਾ ਪਰ ਮੈਨੂੰ ਬਿਲਕੁਲ ਨਿਆਂ ਅਤੇ ਬਿਲਕੁਲ ਸਾਫ਼ ਕੰਪਿਊਟਰ ਚਾਹੀਦਾ ਹੈ ਜਿੱਦਾਂ ਕਿ ਮੈਂ ਪਹਿਲਾਂ ਵੀ ਆਡਰ ਕਰਿਆ ਹੋਈ ਸੀ ਐਚਪੀ ਐਚ ਪੀ ਦੇ ਕੰਪਿਊਟਰ ਮੈਂ ਆਡਰ ਕਰਿਆ ਸੀ ਹੁਣ ਮੈਨੂੰ ਪੂਰਾ ਐਚ ਪੀ ਦਾ ਕੰਪਿਊਟਰ ਚਾਹੀਦਾ ਹੈ ਅਤੇ ਜੋ ਕਿ ਬਿਲਕੁਲ ਸਾਫ਼ ਕੰਡੀਸ਼ਨ ਵਿੱਚ ਹੋਵੇ ਮੈਨੂੰ ਮੇਰਾ ਬਿਲ ਵਗੈਰਾ ਸਾਰਾ ਕੱਟ ਕੇ ਦਿੱਤਾ ਜਾਵੇ ਤੁਸੀਂ ਪਿਛਲੇ ਕੰਪਿਊਟਰ 'ਚ ਬਹੁਤ ਹੀ ਮੇਰੇ ਨਾਲ ਮਾੜਾ ਉਹ ਕੀਤਾ ਹੈ ਜਿਸ ਨਾਲ ਕਿ ਹੁਣ ਮੈਨੂੰ ਆਪਣ ਤੁਸੀਂ ਜਿਹੜਾ ਹੁਣ ਤੁਸੀਂ ਮੈਨੂੰ ਕੰਪਿਊਟਰ ਦਿਓਗੇ ਬਿਲਕੁਲ ਸਾਫ਼ ਅਤੇ ਕਲੀਨ ਕੰਪਿਊਟਰ ਦਿਓ ਧੰਨਵਾਦ ਭਾਜੀ